ਮੈਂ ਜਦੋਂ ਡਰਾਇੰਗ ਬਣਾਉਂਦਾ ਹੈਗਾ ਹਾਂ ਡਰਾਇੰਗ ਬਣਾਉਂਦਾ ਜਿਵੇਂ ਮੈਂ ਭਗਵਾਨ ਦੀ ਡਰਾਇੰਗ ਬਣਾਤੀ ਜਾਂ ਕਿਸੇ ਚੀਜ਼ ਦੀ ਮੈਂ ਡਰਾਇੰਗ ਬਣਾਤੀ ਜੇ ਉਹ ਮੇਰੇ ਦਿਲ ਨੂੰ ਬਹੁਤ ਜ਼ਿਆਦਾ ਚੰਗੀ ਲੱਗਦੀ ਹੈ ਨਾ ਉਹ ਮੈਂ ਕਿਸੇ ਨੂੰ ਨਹੀਂ ਦਊਂਗਾ ਜੇ ਮੈਂ ਉਵੇਂ ਆਪਦੇ ਕਰੀਅਰ ਵਾਸਤੇ ਵੀ ਡਰਾਇੰਗ ਬਣਾਉਂਦਾ ਕਿਸੇ ਨੂੰ ਵੇਚਣ ਵਾਸਤੇ ਡਰਾਇੰਗ ਬਣਾਉਂਦਾ ਫਿਰ ਮੈਂ ਵੇਚ ਦੂੰਗਾ ਜੇ ਮੇਰੇ ਘਰ ਕੋਈ ਡਰਾਇੰਗ ਲੈਣ ਆਉਂਦਾ ਉਹਨੂੰ ਮੈਂ ਐਵੇਂ ਤਾਂ ਨਹੀਂ ਦਊਂਗਾ ਪੈਸੇ ਲੈ ਕੇ ਦਊਂਗਾ ਜਾਂ ਮਿਊਜੀਅਮ 'ਚ ਆਰਟ ਮਿਊਜ਼ੀਅਮ ਵਗੈਰਾ ਹੁੰਦੇ ਆ ਜਿਵੇਂ ਆਨਲਾਈਨ ਹੁੰਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਮੈਂ ਆਪਦੀ ਪੇਂਟਿੰਗ ਵਗੈਰਾ ਪਾਉਂਦਾ ਰਹਿੰਦਾ ਉੱਥੇ ਜਿਹੜੇ ਹੈਗੇ ਆ ਲੋਕ ਦੇਖਦੇ ਹਾਂ ਉਹ ਫਿਰ ਮੈਨੂੰ ਕੰਟੈਕਟ ਕਰਦੇ ਆ ਫਿਰ ਉਹ ਪਰਚੇਸ ਕਰ ਲੈਂਦੇ ਮੇਰੀ ਡਰਾਇੰਗ ਉਹਦੇ ਨਾਲ ਮੇਰੀ ਇਨਕਮ ਬਣ ਜਾਂਦੀ ਹੈਗੀ ਆ ਅਤੇ ਜਿਹੜੀ ਡਰਾਇੰਗ ਮੈਨੂੰ ਬਹੁਤ ਹੀ ਜ਼ਿਆਦਾ ਚੰਗੀ ਲੱਗਦੀ ਆ ਜਿਹਦੇ 'ਤੇ ਮੈਂ ਆਪਦਾ ਪੂਰੀ ਸ਼ਿੱਦਤ ਨਾਲ ਕੰਮ ਕੀਤਾ ਜਿਹੜੀ ਮੈਂ ਆਪਦੇ ਕਿਸੇ ਜਿਹੜੀ ਮੇਰੀ ਲਾਈਫ ਦੇ ਨਾਲ ਸੰਬੰਧਿਤ ਕੰਮ ਹੈਗਾ ਉਹਦੇ 'ਤੇ ਜਦੋਂ ਮੈਂ ਕੰਮ ਕਰਦਾ ਹੈਗਾ ਉਹ ਮੈਂ ਕਰਦਾ ਉਹ ਮੈਂ ਕਿਸੇ ਨੂੰ ਨਹੀਂ ਦਿੰਦਾ ਉਹ ਮੈਂ ਆਪਦੇ ਕੋਲ ਰਾਤ ਮੈਂ ਘਰ 'ਚ ਇੱਕ ਕਮਰਾ ਬਣਾਇਆ ਕਿ ਉੱਥੇ ਮੈਂ ਸਾਰੀਆਂ ਡਰਾਇੰਗਾਂ ਬਣਾ ਕੇ ਰੱਖਦਾ ਜਦੋਂ ਕੋਈ ਮੇਰੇ ਘਰ ਆਉਂਦਾ ਹੈਗਾ ਮੈਂ ਸਾਰਿਆਂ ਨੂੰ ਦਿਖਾਉਂਦਾ ਹੈਗਾ ਉਹ ਕਮਰਾ ਅਤੇ ਇੱਕ ਕਮਰਾ ਅਲੱਗ ਹੈਗਾ ਜਿਹਦੇ 'ਚ ਮੈਂ ਵੇਚਣ ਵਾਲੀਆਂ ਡਰਾਇੰਗਾਂ ਬਣਾਉਂਦਾ ਹੁੰਦਾ ਜਿਹੜੇ ਵੇਚਣੀਆਂ ਜਿਹੜੇ ਖਰੀਦਣੇ ਵਾਲੇ ਆਉਂਦੇ ਹੈਗੇ ਆ ਉਹਨਾਂ ਨੂੰ ਮੈਂ ਉਹ ਵਾਲਾ ਕਮਰਾ ਦਿਖਾਉਂਦਾ ਹੈਗਾ ਮੇਰੇ ਰਿਸ਼ਤੇਦਾਰ ਵਗੈਰਾ ਦੋਸਤ ਉਹਨਾਂ ਨੂੰ ਦੂਜਾ ਕਮਰਾ ਆਪਦੇ ਵਾਸਤੇ ਡਰਾਇੰਗ ਕਰਦਾ ਹੈਗਾ ਡਰਾਇੰਗ ਕਰਨਾ ਬਹੁਤ ਚੰਗਾ ਲੱਗਦਾ ਮੈਨੂੰ ਬਹੁਤ ਮਜ਼ਾ ਆਉਂਦਾ ਡਰਾਇੰਗ ਕਰਨ 'ਚ ਵੱਖ ਵੱਖ ਮੇਨ ਮੇਨ ਚੀਜ਼ਾਂ ਦੀ ਡਰਾਇੰਗ ਕਰਨ 'ਚ ਬਹੁਤ ਮਜ਼ਾ ਆਉਂਦਾ